ਪੰਜਾਬੀ ਮਠਿਆਈਆਂ ਗੁਲਾਬ ਜਾਮੁਨ ਲੱਡੂ ਰਸਮਲਾਈ ਰਸਗੁਲੇ ਸ਼ਕਰਪਾਰੇ ਖੁਰਮੇ ਬਰਫੀ ਖੋਏ ਵਾਲੀ ਬਰਫੀ ਬੇਸਣ ਵਾਲੀ ਬੇਸਨ ਦੇ ਲੱਡੂ ਛੋਲਿਆਂ ਦੇ ਲੱਡੂ ਕਲਾਕੰਦ ਮਿਲਕ ਕੇਕ ਗੁਜੀਆ ਪੇਠਾ ਚਮ ਚਮ ਗਜ਼ਰੇਲਾ ਪਤੀਸਾ ਪੇੜੇ ਮੋਦਕ ਪੰਜੀਰੀ ਜਲੇਬੀ ਮਾਲਪੂੜੇ ਅਮਰਤੀ ਰਬੜੀ ਖੀਰ ਹਲਵਾ ਸੂਜੀ ਦਾ ਵੇਸਨ ਦਾ ਹਲਵਾ ਆਟੇ ਦਾ ਹਲਵਾ ਪੰਜੀਰੀ